ਮੇਰੇ ਇਲਾਕੇ ਵਿਚ ਪਟਿਆਲੇ ਵਿੱਚ ਕੋਈ ਵੀ ਬੀਚ ਨਹੀਂ ਹੈਗਾ ਪਰ ਦੋ ਖ਼ਾਸ ਧਾਰਮਿਕ ਸਥਾਨ ਹਨ ਇੱਕ ਦੂਖਨਿਵਾਰਨ ਸਾਹਿਬ ਦੂਜਾ ਬਹਾਦਰਗੜ੍ਹ ਦੂਖਨਿਵਾਰਨ ਸਾਹਿਬ ਵਿੱਚ ਪੰ ਬਸੰਤ ਪੰਚਮੀ ਮਨਾਈ ਜਾਂਦੀ ਹੈ ਲੋਕ ਇਸ ਦਿਨ ਇੱਥੇ ਆ ਕੇ ਇਸ਼ਨਾਨ ਕਰਦੇ ਹਨ ਇਸ ਦਾ ਇਤਿਹਾਸ ਇਹ ਹੈ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਅਤੇ ਇੱਥੇ ਉਹਨਾਂ ਨੇ ਦੀਵਾਨ ਲਾਏ ਸੀ ਅਤੇ ਬਹੁਤ ਸਾਰੇ ਲੋਕਾਂ ਦੇ ਦੁੱਖ ਦੂਰ ਕੀਤੇ ਸੀ ਉਹਨਾਂ ਨੇ ਇੱਥੇ ਬਚਨ ਦਿੱਤਾ ਸੀਗਾ ਵੀ ਜੋ ਵੀ ਇੱਥੇ ਪੰਚਮੀ ਨੂੰ ਆ ਕੇ ਇਸ਼ਨਾਨ ਕਰੇਗਾ ਉਸਦੇ ਸਾਰੇ ਦੁੱਖ ਟੁੱਟ ਜਾਣਗੇ ਇਸ ਲਈ ਇੱਥੇ ਲੋਕ ਬਸੰਤ ਪੰਚਮੀ ਵਾਲੇ ਦਿਨ ਆ ਕੇ ਜ਼ਰੂਰ ਇਸ਼ਨਾਨ ਕਰਦੇ ਹਨ ਦੂਜਾ ਸਥਾਨ ਬਹਾਦਰਗੜ੍ਹ ਇਸ ਜਗ੍ਹਾ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਇਤਿਹਾਸ ਹੈ ਇੱਥੇ ਜ਼ਿਆਦਾਤਰ ਵਿਸਾਖੀ ਭਰਦੀ ਹੈ ਜੋ ਅਪ੍ਰੈਲ ਮਹੀਨੇ ਦੇ ਵਿੱਚ ਆਉਂਦੀ ਹੈ ਇਸ ਦਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਇੱਥੇ ਦਿੱਲੀ ਜਾਣ ਵੇਲੇ ਜਦੋਂ ਉਹ ਸੀਸ ਦੇਣ ਚੱਲੇ ਸੀ ਤਾਂ ਇੱਥੇ ਰਹਿ ਕੇ ਗਏ ਸੀ ਇੱਥੇ ਉਹਨਾਂ ਨੇ ਤਿੰਨ ਮਹੀਨੇ ਦੋ ਦਿਨ ਲਾਏ ਸੀਗੇ ਇੱਥੇ ਉਹ ਰੋਜ਼ ਦੀਵਾਨ ਲਾਉਂਦੇ ਸੀ ਅਤੇ ਇੱਥੇ ਹੀ ਉਹ ਰਹਿੰਦੇ ਸੀਗੇ ਇੱਥੇ ਲੋਕਾਂ ਦੇ ਦੁੱਖ ਸੁਣਦੇ ਸਨ ਉਹਨਾਂ ਨੂੰ ਸਲਾਹਾਂ ਦਿੰਦੇ ਸੀ ਅਤੇ ਇੱਥੇ ਹੀ ਉਹਨਾਂ ਦੇ ਨਾਂ ਦੇ ਉੱਤੇ ਗੁਰਦੁਆਰਾ ਬਣਾਇਆ ਗਿਆ ਹੈ ਵਿਸਾਖੀ ਦਾ ਮੇਲਾ ਇੱਥੇ ਬਹੁਤ ਵੱਡਾ ਭਰਦਾ ਹੈ ਲੋਕ ਦੂਰੋਂ ਦੂਰੋਂ ਇੱਥੋਂ ਦਾ ਵਿਸਾਖੀ ਦਾ ਮੇਲਾ ਦੇਖਣ ਲਈ ਆਉਂਦੇ ਹਨ